ਪੰਜਾਬ ਦੇ ਪਿੰਡਾਂ ਦੇ ਮਸਲੇ ਪਿੰਡਾਂ ਦੇ ਘਰਾਂ ਅਤੇ ਪੰਚਾਇਤਾਂ ਵਿੱਚ ਹੀ ਅਕਸਰ ਨਿਬੇੜੇ ਜਾਂਦੇ ਰਹੇ ਹਨ ਅਤੇ ਇਹ ਪਰੰਪਰਾ ਅੱਜ ਵੀ ਚੱਲਦੀ ਆ ਰਹੀ ਹੈ ਅਤੇ ਇਸੇ ਤਰ੍ਹਾਂ ਹਰ ਇੱਕ ਘਰ ਪਰਿਵਾਰ ਵਿੱਚ ਛੋਟੀ ਛੋਟੀ ਲੜਾਈਆਂ ਛੋਟੀ ਛੋਟੀ ਚੀਜ਼ਾਂ ਅਤੇ ਭੈਣ ਭਰਾਵਾਂ ਦੇ ਮਸਲਿਆਂ ਤੋਂ ਲੈ ਕੇ ਵੱਡੇ ਸ਼ਰੀਕੇ ਬਾਜ਼ੀਆਂ ਦੇ ਮਸਲੇ ਹੁੰਦੇ ਰਹਿੰਦੇ ਹਨ ਜੋ ਕਿ ਘਰ ਤੋਂ ਲੈ ਕੇ ਕਚਹਿਰੀਆਂ ਤੱਕ ਵੀ ਚਲੇ ਜਾਂਦੇ ਹਨ ਪਰ ਹਾਲ ਹੀ ਵਿੱਚ ਸਾਡੇ ਘਰੇ ਦੋ ਮਹੀਨੇ ਪਹਿਲਾਂ ਇੱਕ ਜਾਨਵਰ ਆ ਕੇ ਵੜ ਗਿਆ ਅਤੇ ਉਸ ਨੇ ਬਹੁਤ ਸਾਰਾ ਨੁਕਸਾਨ ਕੀਤਾ ਅਤੇ ਜਿਸ ਕਰਕੇ ਮੇਰੇ ਵੱਡੇ ਭਾਈ ਨੇ ਮੇਰੀ ਮੰਮੀ ਨੂੰ ਦੋਸ਼ੀ ਠਹਿਰਾਇਆ ਕਿ ਤੁਸੀਂ ਗੇਟ ਨਹੀਂ ਬੰਦ ਕੀਤਾ ਅਤੇ ਉਹਨਾਂ ਨੇ ਮੈਨੂੰ ਦੋਸ਼ੀ ਠਹਿਰਾਇਆ ਕਿ ਤੁਸੀਂ ਘਰ ਧਿਆਨ ਨਹੀਂ ਰੱਖਦੇ ਪਰ ਇਸ ਦਾ ਹੌਲੀ ਹੌਲੀ ਸਾਡੇ ਬਜ਼ੁਰਗਾਂ ਨੇ ਉਸ ਨੂੰ ਸਭ ਨੂੰ ਜਦੋਂ ਆਏ ਉਹਨਾਂ ਨੇ ਦਬਕਾ ਮਾਰਿਆ ਅਤੇ ਸਾਰੇ ਚੁੱਪ ਚਾਪ ਚੁੱਪ ਕਰ ਗਏ ਅਤੇ ਇੱਥੋਂ ਸਿੱਖਣ ਨੂੰ ਮਿਲਦਾ ਹੈ ਕਿ ਜਿਹੜੇ ਪਿੰਡਾਂ ਦੇ ਵੱਡੇ ਬਜ਼ੁਰਗ ਹਨ ਉਹਨਾਂ ਦਾ ਆਦਰ ਸਨਮਾਨ ਹਾਲੇ ਵੀ ਬਾ ਬਰਕਰਾਰ ਹੈ ਅਤੇ ਪਿੰਡਾਂ ਦੇ ਵਿੱਚ ਅਸਲ ਮਾਮਲੇ ਵੱਡਿਆਂ ਦੇ ਦਾਬ ਅਤੇ ਦਬਾਓ ਦੇ ਨਾਲ ਹੀ ਨਜਿੱਠੇ ਜਾਂਦੇ ਹਨ ਅਤੇ ਇਹ ਹੀ ਪਰੰਪਰਾ ਅੱਗੇ ਸਾਲਾਂ ਵਿੱਚ ਚੱਲਦੀ ਰਹੇਗੀ ਅਤੇ ਇਹ ਹੀ ਪੰਜਾਬ ਦੀ ਸਾਡੇ ਘਰਾਂ ਪਰਿਵਾਰਾਂ ਦੇ ਪਿੰਡਾਂ ਦੀ ਪਛਾਣ ਹੈ